ਹਾਂਜੀ ਜਿਸ ਤਰ੍ਹਾਂ ਕਿ ਧਿਆਨ ਵਿੱਚ ਆਇਆ ਹੈ ਕਿ ਆਪਣੀ ਐਨ ਜੀ ਓਜ ਦੁਆਰਾ ਇੱਕ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਸੋ ਇਸ ਖੂਨਦਾਨ ਕੈਂਪ ਦੇ ਵਿੱਚ ਮੈਂ ਖੂਨਦਾਨ ਮਹਾਂ ਕਲਿਆਣ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਖੂਨਦਾਨ ਮਹਾਂ ਦਾਨ ਹੈ ਮਨੁੱਖੀ ਜ਼ਿੰਦਗੀਆਂ ਨੂੰ ਬਚਾਉਣ ਦੇ ਲਈ ਖੂਨ ਦੀ ਬਹੁਤ ਮਹੱਤਤਾ ਹੈ ਸੋ ਇਸ ਨੋਬਲ ਕੋਜ਼ ਦੇ ਲਈ ਮੈਂ ਆਪਣੇ ਆਪ ਨੂੰ ਪੇਸ਼ ਕਰ ਰਿਹਾ ਸੋ ਮੈਂ ਖੂਨਦਾਨ ਦੇ ਲਈ ਦਿਲਚਸਪੀ ਰੱਖਦਾ ਹਾਂ ਸੋ ਆਪ ਦੁਆਰਾ ਆਯੋਜਿਤ ਇਸ ਖੂਨਦਾਨ ਕੈਂਪ ਦੇ ਵਿੱਚ

ਧਰਮਵੀਰ ਸਿੰਘ ਚਾਹੁੰਦਾ ਹਾਂ ਕਿ ਇਸ ਵਿੱਚ ਖੂਨ ਦਾਨ ਕੀਤਾ ਜਾਵੇ ਅਤੇ ਇਸ ਨੋਬਲ ਕੋਜ਼ ਦੇ ਵਿੱਚ ਹਿੱਸਾ ਜਿਹੜਾ ਉਹ ਪਾਇਆ ਜਾ ਸਕੇ ਸੋ ਮੈਂ ਆਪ ਜੀ ਨਾਲ ਸੰਪਰਕ ਕਰਕੇ ਆਪਣੇ ਵੇਰਵੇ ਆ ਜੋ ਪ੍ਰਦਾਨ ਕਰ ਰਿਹਾ ਹਾਂ ਅਤੇ ਕਿਰਪਾ ਕਰਕੇ ਜੋ ਹੈ ਮੈਨੂੰ ਕੌਲ ਕੀਤੀ ਜਾਵੇ ਖੂਨ ਦਾਨ ਕੈਂਪ ਵਾਲੇ ਦੇ ਵਿੱਚ ਮੇਰੇ ਤੋਂ ਜੋ ਮੈਂ ਖੂਨਦਾਨ ਕਰਨਾ ਚਾਹੁੰਦਾ ਉਸ ਲਈ ਮੈਨੂੰ ਕੌਲ ਕੀਤੀ ਜਾਵੇ ਮੇਰਾ ਨਾਮ ਨੋਟ ਕੀਤਾ ਜਾਵੇ ਅਤੇ ਪੂਰੀ ਚੈਕਅਪ ਤੋਂ ਬਾਅਦ ਜੇਕਰ ਮੈਂ ਖੂਨਦਾਨ ਦੇ ਲਈ ਫਿਟ ਹਾਂ ਤਾਂ ਕਿਰਪਾ ਕਰਕੇ ਮੈਨੂੰ ਇਹ ਜੋ ਮੌਕਾ ਹੈ ਉਹ ਜ਼ਰੂਰ ਦਿੱਤਾ ਜਾਵੇ ਦਿੱਤਾ ਜਾ ਜਾਵੇ ਤਾਂ ਹੀ ਇਸ ਨੋਬਲ ਕੋਜ਼ ਦੇ ਵਿੱਚ ਮੈਂ ਵੀ ਹਿੱਸਾ ਪਾ ਸਕਾਂ ਅਤੇ ਮਨੁੱਖੀ ਜ਼ਿੰਦਗੀਆਂ ਜੋ ਹੈ ਬਚਾਉਣ ਦੇ ਵਿੱਚ ਮੈਂ ਕਰ ਸਕਾਂ ਸੋ ਪਲੀਜ਼ ਪਹਿਲਾਂ ਚੈੱਕਅਪ ਕਰਕੇ ਮੇਰਾ ਜੇ ਖੂਨਦਾਨ ਲਈ ਮੈਂ ਫਿਟ ਹਾਂ ਤਾਂ ਜ਼ਰੂਰ ਮੈਂ ਆਪਣੇ ਆਪ ਨੂੰ ਪੇਸ਼ ਕਰਕੇ ਆਪ ਜੀ ਦਾ ਧੰਨਵਾਦੀ ਸਮਝਾਂਗਾ ਧੰਨ ਧੰਨਵਾਦ ਜੀ